ਮੈਨੂੰ ਜ਼ਿੰਦਗੀ ਦੇ ਵਿੱਚ ਕਾਫ਼ੀ ਘੱਟ ਸਮਾਂ ਹੀ ਮਿਲਦਾ ਹੈ ਸੰਗੀਤ ਉਤਸਵ ਜਾਂ ਕਿਸੇ ਵੀ ਸਮਾਗਮ ਵਿੱਚ ਜਾਣ ਦਾ ਪਰ ਇੱਕ ਵਾਰ ਅਸੀਂ ਮੈਂ ਅਤੇ ਮੇਰੀਆਂ ਸਹੇਲੀਆਂ ਅਸੀਂ ਇੱਕ ਕਰਾਫ਼ਟ ਮੇਲੇ ਘੁੰਮਣ ਗਏ ਉੱਥੇ ਅਸੀਂ ਘੁੰਮੇ ਅਤੇ ਉੱਥੇ ਅਚਾਨਕ ਹੀ ਅਨਾਊਸਮੈਂਟ ਹੋਈ ਅਤੇ ਕੀ ਕਹਿੰਦੇ ਉਹ ਕਲਾਕਾਰ ਨੇ ਆਉਣਾ ਸੀ ਅਤੇ ਉਨ੍ਹਾਂ ਨੇ ਸਮਾਂ ਦੱਸਿਆ ਅਤੇ ਅਸੀਂ ਉੱਥੇ ਬੈਠ ਗਏ ਕਾਫ਼ੀ ਕਲਾਕਾਰ ਉੱਥੇ ਆਏ ਆਪਣਾ ਉਨ੍ਹਾਂ ਨੇ ਗੀਤ ਸ ਸੰਗੀਤ ਗਾਇਆ ਅਤੇ ਲੋਕਾਂ ਨੂੰ ਬਹੁਤ ਪਸੰਦ ਵੀ ਆਇਆ ਲੋਕ ਕਈ ਖੁਸ਼ ਹੋਏ ਅਤੇ ਕਈ ਨੱਚ ਰਹੇ ਸਨ ਕ ਬਹੁਤ ਹੀ ਬੱਚੇ ਵਗੈਰਾ ਸਭ ਰੌਲਾ ਪਾ ਰਹੇ ਸੀ ਅਤੇ ਖੁਸ਼ ਵੀ ਹੋਏ ਸੰਗੀਤ ਕਲਾਕਾਰਾਂ ਅਤੇ ਵੱਡੇ ਪੱਧਰ 'ਤੇ ਜਿੰਨੇ ਵੀ ਵਿਅਕਤੀ ਸਨ ਸਾਰੇ ਬਹੁਤ ਖੁਸ਼ ਸਨ ਕਾਫ਼ੀ ਸਮਾਂ ਵੇਟ ਕਰਨ ਕਾਰਨ ਕਾਫ਼ੀ ਲੋਕ ਉੱਥੇ ਨਿਰਾਸ਼ ਵੀ ਹੋਏ ਜਿਨ੍ਹਾਂ ਨੂੰ ਅੱਛਾ ਨਾ ਲੱਗਿਆ ਅਤੇ ਉਹ ਉੱਠ ਕੇ ਚਲੇ ਗਏ ਪਰ ਬਾਅਦ ਵਿੱਚ ਇਹ ਮਾਹੌਲ ਬਹੁਤ ਹੀ ਵਧੀਆ ਬਣ ਗਿਆ ਅਤੇ ਕਾਫ਼ੀ ਲੋਕ ਉੱਥੇ ਆਪਣਾ ਸਮਾਂ ਬਤੀਤ ਕੀਤਾ ਕਾਫ਼ੀ ਉੱਥੇ ਘੁੰਮੇ ਫਿਰੇ ਖਾਣਾ ਖੁਣਾ ਖਾਇਆ ਸਭ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਿਠਾਇਆ ਅਤੇ ਸਭ ਨੂੰ ਵਧੀਆ ਤਰੀਕੇ ਨਾਲ ਗੱਲ ਹੋਈ ਸਾਰੇ ਬਹੁਤ ਉਨ੍ਹਾਂ ਦਾ ਸਮਾਗਮ ਦੇਖ ਕੇ ਖੁਸ਼ ਵੀ ਹੋਏ ਜੋ ਕਿ ਬਹੁਤ ਵਧੀਆ ਸੀ